ਅੱਜ ਕੱਲ੍ਹ ਇਹ ਹੁਨਰ ਬਹੁਤ ਵੱਧ ਰਿਹਾ ਹੈ ਸਾਡੇ ਆਸਪਾਸ ਦੇ ਇਲਾਕਿਆਂ ਵਿੱਚ ਬਹੁਤ ਆਰਟ ਮੇਲੇ ਲੱਗ ਲੱਗ ਰਹੇ ਹਨ ਉੱਥੇ ਬਹੁਤ ਦੂਰ ਦੂਰ ਤੋਂ ਆਰਟ ਆਰਟ ਵਾਲੇ ਪਹੁੰਚਦੇ ਹਨ ਉਹ ਆਪਣੇ ਮਿੱਟੀ ਦੇ ਭਾਂਡੇ ਬਣ ਬਣਾਉਣ ਬਣਾਉਣ ਬਣਾ ਕੇ ਲੈ ਕੇ ਆਉਂਦੇ ਹਨ ਉਹ ਉਹਦੇ ਉੱਪਰ ਉਹ ਪੇਟਿੰਗ ਬਣਾ ਕੇ ਲੇੈ ਕੇ ਆਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਮਿੱਟੀ ਦੇ ਭਾਂਡੇ ਬਹੁਤ ਵਧੀਆ ਲੱਗਣ ਲੱਗ ਜਾਂਦੇ ਹਨ ਜਿਨ੍ਹਾਂ ਨਾਲ ਉਹਨੂੰ ਵਧੀਆ ਪੈਸਾ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਹੌਂਸਲਾ ਮਿਲਦਾ ਹੈ ਅਤੇ ਸਾਡਾ ਸੱਭਿਆਚਾਰਕ ਉੱਚਾ ਚੁੱਕ ਹੁੰਦਾ ਹੈ